ਹਾਂਜੀ ਮੈਂ ਕੁੱਕੜ ਦੀ ਲੜਾਈ ਵੇਖੀ ਹੈ ਜਿਸ ਵਿੱਚ ਕਿਆ ਹੁੰਦਾ ਹੈ ਪਹਿਲਾਂ ਤਾਂ ਜਿਵੇਂ ਉਹ ਕੁੱਕੜ ਦੀ ਐਨ ਮਤਲਬ ਕੇਅਰ ਕਰਦਾ ਜਿਹੜਾ ਉਹਦਾ ਔਨਰ ਹੁੰਦਾ ਕਿਉਂਕਿ ਉਹ ਲੜਾਈਆਂ ਲੜਾਉਣ ਲੈੇ ਕੇ ਜਾਂਦੇ ਹੈ ਉਨ੍ਹਾਂ ਦੀ ਡਾਈਟ ਦੀ ਗੱਲ ਕਰਾਂ ਤਾਂ ਮੁਰਗਿਆਂ ਤੱਕ ਨੂੰ ਬਦਾਮ ਕਾਜੂ ਵਗੈਰਾ ਖਿਲਾਉਂਦੇ ਹੈ ਅਤੇ ਉਨ੍ਹਾਂ ਦੇ ਮੁਰਗੇ ਵੇਖਣ ਯੋਗ ਹੁੰਦੇ ਹਨ ਹਾਈਟ ਵੀ ਉਨ੍ਹਾਂ ਦੀ ਬਹੁਤ ਅੱਛੀ ਹੁੰਦੀ ਹੈ ਐਨ ਤਰੀਕਿਆਂ ਨਾਲ ਲੜਾਉਣਾ ਸਿਖਾਉਂਦੇ ਹੈ ਉਨ੍ਹਾਂ ਨੂੰ ਅਤੇ ਜਦੋਂ ਉਹ ਲੜਦੇ ਹਨ ਅਤੇ ਐਨ ਉਨ੍ਹਾਂ ਦੀਆਂ ਬਾਜ਼ੀਆਂ ਲੱਗਦੀਆਂ ਹਨ ਜਿਹੜਾ ਕੁੱਕੜ ਜ਼ਿਆਦਾਤਰ ਤੱਕ ਮੈਦਾਨ ਵਿੱਚ ਟਿੱਕਦਾ ਹੈ ਉਹ ਉਨ੍ਹਾਂ ਦੇ ਇਨਾਮ ਅਲੱਗ ਅਲੱਗ ਹੁੰਦੇ ਜਿਵੇਂ ਕਿਸੇ ਦੇ ਪੰਜ ਹਜ਼ਾਰ ਦਾ ਇਨਾਮ ਕਦੇ ਗਿਆਰ੍ਹਾਂ ਹਜ਼ਾਰ ਦਾ ਇਨਾਮ ਜਿਸ ਕਰਕੇ ਬੰਦੇ ਉਨ੍ਹਾਂ ਉੱਪਰ ਜ਼ਿਆਦਾ ਫੋਕਸ ਕਰਦੇ ਹਨ